ਅੱਜ ਕੱਲ੍ਹ ਦੇ ਪੋਲਿਊਸ਼ਨ ਦੇ ਮਾਹੌਲ ਦੇ ਵਿੱਚ ਹਰ ਇੱਕ ਆਦਮੀ ਸਾਫ਼ ਪਾਣੀ ਦੀ ਜ਼ਰੂਰਤ ਨੂੰ ਸਮਝਦੇ ਹੋਏ ਜ਼ਿਆਦਾਤਰ ਘਰਾਂ ਵਿੱਚ ਉਬਾਲ ਕੇ ਪਾਣੀ ਪੀਤਾ ਜਾ ਰਿਹਾ ਹੈ ਇਸ ਦੇ ਲਈ ਅਸੀਂ ਵੀ ਹਮੇਸ਼ਾਂ ਹੀ ਆਪਣੇ ਜੋ ਪੀਣ ਲਈ ਪਾਣੀ ਹੁੰਦਾ ਉਸ ਨੂੰ ਉਬਾਲ ਕੇ ਹੀ ਪੀਂਦੇ ਹਾਂ ਪਰ ਪਿਛਲੇ ਦਿਨੀਂ ਮੈਂ ਗੌਰ ਕੀਤਾ ਕਿ ਜਦੋਂ ਅਸੀਂ ਪਾਣੀ ਉਬਾਲ ਰਹੇ ਹੁੰਦੇ ਹਾਂ ਤਾਂ ਉਸਦੇ ਵਿੱਚ ਇੱਕ ਉੱਪਰ ਅਜੀਬ ਜਿਹੀ ਝੱਗ ਆ ਜਾਂਦੀ ਹੈ ਪਰ ਇਸ ਵਾਰ ਮੇਰਾ ਮਨ ਇਸ ਨੂੰ ਦੇਖ ਕੇ ਬੜਾ ਹੀ ਖਟਕਿਆ ਕਿਉਂਕਿ ਉਸ ਪਾਣੀ ਦੇ ਵਿੱਚੋਂ ਅਜੀਬ ਤਰ੍ਹਾਂ ਦੀ ਸਮੈਲ ਵੀ ਆ ਰਹੀ ਸੀ ਮੈਂ ਗੈਸ ਨੂੰ ਬੰਦ ਕਰਕੇ ਉਸ ਪਾਣੀ ਨੂੰ ਥੋੜ੍ਹਾ ਜਿਹਾ ਜਦੋਂ ਟੇਸਟ ਕੀਤਾ ਤਾਂ ਇਸ ਦੇ ਟੇਸਟ ਵਿੱਚ ਵੀ ਇੱਕ ਅਜੀਬ ਜਿਹੀ ਸਮੈਲ ਸੀ ਔਰ ਅਜੀਬ ਜਿਹਾ ਟੇਸਟ ਸੀ ਜਿਸ ਦੇ ਸਬੰਧ ਵਿੱਚ ਮੇਰੇ ਮਨ ਦੇ ਵਿੱਚ ਇਹ ਆਇਆ ਕਿ ਇਸ ਪਾਣੀ ਦੀ ਗੁਣਵੱਤਾ ਦੇ ਸੰਬੰਧ ਦੇ ਵਿੱਚ ਜੋ ਪੰਜਾਬ ਜਲ ਬੋਰਡ ਹੈ ਉਸ ਦੇ ਨਾਲ ਸੰਬੰਧ ਸਥਾਪਿਤ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਪਾਣੀ ਦੇ ਵਿੱਚ ਆ ਰਹੀ ਸਮੱਸਿਆ ਦੇ ਸੰਬੰਧ ਵਿੱਚ ਜਾਣਕਾਰੀ ਉਪਲਬਧ ਕਰਵਾਈ ਜਾ ਸਕੇ ਅਤੇ ਉਹਨਾਂ ਦੇ ਨਾਲ ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇ ਕਿਉਂ ਜੋ ਪਾਣੀ ਜ਼ਿੰਦਗੀ ਦਾ ਮੇਨ ਜ਼ਿੰਦਗੀ ਜਿਉਣ ਦਾ ਮੇਨ ਸੋਮਾ ਹੈ ਅਤੇ ਇਸ ਦੇ ਵਿੱਚ ਗੰਦਗੀ ਦਾ ਮਤਲਬ ਬਹੁਤ ਸਾਰੀਆਂ ਬਿਮਾਰੀ ਨੂੰ ਆਪਣੇ ਹੱਥੀਂ ਨਿਮੰਤਰ ਨੂੰ ਦੇਣਾ ਹੈ ਇਸ ਦੇ ਸੰਬੰਧ ਵਿੱਚ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਕਿਰਪਾ ਕਰਕੇ ਪਾਣੀ ਦੇ ਸਫਾਈ ਦਾ ਖ਼ਾਸ ਤੌਰ 'ਤੇ ਧਿਆਨ ਰੱਖਣ ਅਤੇ ਪਾਣੀ ਦੇ ਵਿੱਚ ਸਮੇਂ ਸਮੇਂ 'ਤੇ ਪਾਣੀ ਦੇ ਟੈਂਕੀਆਂ ਦੇ ਵਿੱਚ ਜੋ ਪਾਣੀ ਦੀ ਸਫਾਈ ਦੇ ਲਈ ਕਲੋਰੀਨ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਦੀ ਮਿਆਦ ਦੇ ਸਬੰਧ ਵਿੱਚ ਉਸ ਦੇ ਮਿਆਦ ਨੂੰ ਨਿਰਧਾਰਿਤ ਕਰਕੇ ਪ੍ਰੋਪਰ ਟਾਈਮ 'ਤੇ ਉਹਦੇ ਵਿੱਚ ਕਲੋਰੀਨ ਮਿਲਾਈ ਜਾਵੇ ਤਾਂ ਕਿ ਸਾਰੇ ਜੋ ਪੰਜਾਬ ਦੇ ਲੋਕ ਹਨ ਜਾਂ ਸਾਰੇ ਦੇਸ਼ ਦੇ ਜੋ ਲੋਕ ਹਨ ਉਹਨਾਂ ਨੂੰ ਇੱਕ ਬੇਹੱਦ ਸਾਫ਼ ਸੁਥਰਾ ਪਾਣੀ ਮਿਲ ਸਕੇ ਤਾਂ ਜੋ ਸਮਾਜ ਦੇ ਵਿੱਚ ਜੋ ਪਾਣੀ ਦੇ ਨਾਲ ਪੇਟ ਸੰਬੰਧੀ ਬਿਮਾਰੀਆਂ ਹੁੰਦੀਆਂ ਟਾਈਫਾਇਡ ਹੋ ਰਿਹਾ ਹੈ ਜਾਂ ਹੋਰ ਪੇਟ ਦੀਆਂ ਕਈ ਸਾਰੀਆਂ ਬਿਮਾਰੀਆਂ ਹੋ ਰਹੀਆਂ ਹਨ ਉਹਦੇ ਲਈ ਉਹਦੇ ਤੋਂ ਬਚਾ ਹੋ ਸਕੇ ਜੀ ਧੰਨਵਾਦ ਠੀਕ ਆ ਹਾਂ ਬਹੁਤ ਸੋਹਣਾ ਬੋਲਿਆ